ਹਾਂਜੀ ਭੰਗੜਾ ਐਰੋਬਿਕਸ ਤੌਰ 'ਤੇ ਬੜੀ ਵਧੀਆ ਗਤੀਵਿਧੀ ਹੈ ਕਿਉਂਕਿ ਭੰਗੜਾ ਕਰਨ ਨਾਲ ਕੱਲੇ ਸਾਡੇ ਸਰੀਰ ਦੀ ਐਕਸਰਸਾਈਜ਼ ਨਹੀਂ ਹੁੰਦੀ ਕੱਲਾਂ ਸਾਡਾ ਸਰੀਰ ਹੀ ਨਹੀਂ ਹੁੰਦਾ ਸਾਡਾ ਮਨ ਵੀ ਬੜਾ ਤੰਦਰੁਸਤ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਇਕੱਲਾ ਭਾਰ ਉਠਾਦੇ ਆਂ ਜਾਂ ਕੋਈ ਹੋਰ ਦੌੜਦੇ ਹਨ ਤੇ ਅਸੀਂ ਉਸ ਵਿੱਚ ਥੋੜਾ ਜਿਹਾ ਬੋਰਿੰਗ ਵੀ ਅਨੁਭਵ ਕਰਦੇ ਹਨ ਲੇਕਿਨ ਜਦੋਂ ਅਸੀਂ ਭੰਗੜਾ ਕਰਦੇ ਹਾਂ ਜਦ ਉਧਰੋਂ ਸੰਗੀਤ ਚਲਦਾ ਹੈ ਤੇ ਉਸਦੇ ਨਾਲ ਨਾਲ ਆਪਣੇ ਹੱਥ ਪੈਰਾਂ ਨੂੰ ਹਿਲਾਂਦੇ ਹਨ ਪੰਜਾਬੀ ਹੋਣ ਦੇ ਤੌਰ 'ਤੇ ਤਾਂ ਭੰਗੜੇ ਨਾਲ ਬੰਦੇ ਦੀਆਂ ਨਸਾ ਹੀ ਖੁਲ ਜਾਂਦੀਆਂ ਹਨ ਕਿਉਂਕਿ ਭੰਗੜਾ ਭੰਗੜਾ ਤਾਂ ਪੰਜਾਬੀਆਂ ਦੇ ਸ਼ਾਨ ਹੈ ਚਾਹੇ ਕੋ ਔਰਤ ਹੈ ਚਾਹੇ ਕੋਈ ਮਰਦ ਹੈ ਚਾਹੇ ਬੱਚਾ ਹੈ ਚਾਹੇ ਬੁੱਢਾ ਹੈ ਢੋਲ ਵੱਜਣ ਦੇ ਤਾਲ ਨਾਲ ਹੀ ਪੰਜਾਬੀਆਂ ਦੇ ਪੈਰ ਆਪਣੇ ਆਪ ਹੀ ਚੱਲਣੇ ਸ਼ੁਰੂ ਹੋ ਜਾਂਦੇ ਹਨ ਭੰਗੜਾ ਭੰਗੜਾ ਕਰਨ ਨਾਲ ਇੱਕ ਤਾਂ ਸਾਡੀ ਐਕਸਰਸਾਈਜ਼ ਹੁੰਦੀ ਹੈ ਸਾਡਾ ਮਨ ਮਨ ਫਰੈੱਸ਼ ਹੁੰਦਾ ਹੈ ਤੇ ਇਸ ਦੇ ਨਾਲ ਨਾਲ ਸਰੀਰ ਦਾ ਵਾਧੂ ਭਾਰ ਵੀ ਹਲਕਾ ਹੁੰਦਾ ਹੈ ਮਸਲਜ ਵੀ ਬਿਲਡ ਹੁੰਦੇ ਹਨ ਦਿਮਾਗ ਵੀ ਤਾਜਾ ਹੁੰਦਾ ਹੈ ਵਾਧੂ ਚਰਬੀ ਵੀ ਘੱਟਦੀ ਹੈ ਤੇ ਸਰੀਰ ਦੇ ਵਿੱਚ ਜਿਹੜੇ ਕਈ ਤਣਾਵ ਐਗਜਾਇਟੀ ਉਹਨਾਂ ਦਾ ਵੀ ਘੱਟ ਹੁੰਦਾ ਹੈ ਭੰਗੜੇ ਕਰਨ ਨਾਲ ਵੀਆਮ ਕਰਨ ਦੇ ਨਾਲ ਨਾਲ ਮਨੋ ਮਨੋਵਿਗਿਆਨਿਕ ਤੌਰ ਤੇ ਵੀ ਮਨ ਫਰੈਸ਼ ਹੁੰਦਾ ਹੈ ਕਈ ਚੀਜ਼ਾਂ ਚੰਗੀਆਂ ਲੱਗਦੀਆਂ ਹਨ ਕਿਉਂਕਿ ਅਗਰ ਅਸੀਂ ਇਕੱਲਾ ਦੋੜੀ ਜਾਈਏ ਕਈ ਵਾਰੀ ਮਨ ਨਹੀਂ ਵੀ ਚੰਗਾ ਲੱਗਦਾ ਲੇਕਿਨ ਭੰਗੜੇ ਦੇ ਤਾ ਵਿਅਕਤੀ ਦਾ ਮਨ ਬਹੁਤ ਖੁਸ਼ ਅਨੁਭਵ ਕਰਦਾ ਖਾਸ ਕਰਕੇ ਪੰਜਾਬੀਆਂ ਦਾ ਕਿਉਂਕਿ ਭੰਗੜਾ ਤਾਂ ਪੰਜਾਬੀਆਂ ਦੇ ਜਾਨ ਹੈ ਆਨ ਹੈ ਪੰਜਾਬੀ ਹੋਣ ਤਾਂ ਭੰਗੜਾ ਨਾ ਕਰਨ ਇਸਦਾ ਹੋਈ ਨੀ ਸਕਦਾ ਧੰਨਵਾਦ